ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਜਿੰਦਰ ਸਿੰਘ ਗੱਲ ਕਰਦਾ ਪਿਆ ਅਤੇ ਮੈਂ ਸੈਕਟਰ ਸਤਾਰਾਂ ਤੋਂ ਸੈਕਟਰ ਪੰਦਰਾਂ ਏ ਵਿਖੇ ਜਾਣਾ ਸੀ ਅਤੇ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਕੀ ਮੈਂ ਨਗਦੀ ਰਾਹੀਂ ਭੁਗਤਾਨ ਕਰ ਸਕਦਾ ਹਾਂ ਕਿਉਂਕਿ ਮੈਂ ਔਨਲਾਈਨ ਪੇਮੈਂਟ ਐਪ ਨਹੀਂ ਯੂਜ ਕਰਦਾ ਅਤੇ ਤੁਸੀਂ ਉਹ ਔਨਲਾਈਨ ਪੇਮੈਂਟ ਐਪ ਦੀ ਜੋ ਦਿੱਤੀ ਹੋਈ ਹੈ ਉਦਾਹਰਨ ਕਿਉਂਕਿ ਔਨਲਾਈਨ ਪੇਮੈਂਟ ਮੈਂ ਐਪ ਇਸ ਇਸ ਕਰਕੇ ਨਹੀਂ ਯੂਜ ਕਰਦਾ ਕਿ ਮੈਂ ਮੇਰੇ ਨਾਲ ਇੱਕ ਵਾਰ ਬਹੁਤ ਵੱਡਾ ਫਰੋਡ ਹੋ ਗਿਆ ਸੀ ਔਨਲਾਈਨ ਪੇਮੈਂਟ ਦੇ ਕਾਰਨ ਹੀ ਮੇਰੇ ਖਾਤੇ ਵਿੱਚੋਂ ਬਹੁਤ ਸਾਰੇ ਪੈਸੇ ਚੋਰੀ ਹੋ ਗਏ ਸੀ ਇਸ ਕਰਕੇ ਮੈਂ ਉਹ ਕਦੀ ਵੀ ਬਾਅਦ ਵਿੱਚ ਔਨਲਾਈਨ ਪੇਮੈਂਟ ਐਪ ਨਹੀ ਯੂਜ ਕੀਤਾ ਅਤੇ ਤੁਸੀਂ ਔਨਲਾਈਨ ਪੇਮੈਂਟ ਰਾਹੀਂ ਪੇਮੈਂਟ ਕਰਦੇ ਹੋ ਭੁਗਤਾਨ ਕਰਦੇ ਆ ਅਤੇ ਮੈਂ ਔਨਲਾਈਨ ਭੁਗਤਾਨ ਨਹੀਂ ਕਰ ਸਕਦਾ ਇਸ ਕਰਕੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਉਸ ਜਗ੍ਹਾ ਪਹੁੰਚ ਕੇ ਤੁਹਾਨੂੰ ਜੋ ਕੈਸ਼ ਦੇ ਦੇਵਾਂਗਾ ਨਗਦੀ ਹਾਂਜੀ ਕੀ ਮੈਂ ਉੱਥੇ ਪਹੁੰਚ ਕੇ ਤੁਹਾਨੂੰ ਨਗਦੀ ਭੁਗਤਾਨ ਦੇ ਸਕਦਾ